ਤਰਨਤਾਰਨ ਜਿਲ੍ਹੇ ਵਿੱਚ ਕੁਝ ਮਨੋਰੰਜਕ ਖੇਡਾਂ ਹਨ ਜੋ ਲੋਕਾਂ ਨੂੰ ਇਕੱਠੇ ਕਰਨ ਵਿੱਚ ਇਸਤੇਮਾਲ ਹੁੰਦੀਆਂ ਹਨ ਜਿਵੇਂ ਵਾਲੀਬਾਲ ਕ੍ਰਿਕਟ ਬੈਡਮਿੰਟਨ ਸਕੇਟਿੰਗ ਆਦਿ ਵਾਲੀਬਾਲ ਖੇਡ ਨੂੰ ਲੋਕਾਂ ਦੀ ਭਾਵਨਾਵਾਂ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ ਲੋਕ ਇਸ ਖੇਡ ਵਿੱਚ ਹਾਸ ਰਾਸ ਪੈਦਾ ਕਰਦੇ ਹਨ ਕ੍ਰਿਕਟ ਮੈਚਾਂ ਨੂੰ ਵਧੇਰੇ ਰੂਪਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਪਹਿਲਾਂ ਰੱਖਿਆ ਜਾਂਦਾ ਹੈ ਅਤੇ ਲੋਕ ਇਕੱਠੇ ਆਉਂਦੇ ਹਨ ਅਤੇ ਮੈਚ ਦੀ ਉਤਸ਼ਾਹਿਤ ਭਾਵਨਾ ਨੂੰ ਅਨੁਭਵ ਕਰਦੇ ਹਨ ਇਹ ਖੇਡਾਂ ਲੋਕਾਂ ਦੇ ਸਮੂਹ ਭਾਵਨਾ ਨੂੰ ਇਕੱਠਾ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਸਾਥ ਵਿੱਚ ਆਉਣ ਵਾਲੇ ਸਮਾਜ ਨੂੰ ਇੱਕ ਭਾਈਚਾਰੇ ਦੀ ਭਾਵਨਾ ਵਿੱਚ ਇਕੱਠਾ ਕਰਦੀਆਂ ਹਨ